ਅੱਜ ਮੈਂ ਤੁਹਾਨੂੰ ਸਾਗ ਬਣਾਉਣ ਬਾਰੇ ਦੱਸਾਂਗੀ ਸਭ ਤੋਂ ਪਹਿਲਾਂ ਸਾਗ ਨੂੰ ਧੋ ਲਵੋ ਸਵਾਰ ਲਓ ਅਤੇ ਧੋ ਲਓ ਧੋ ਕੇ ਇਸਨੂੰ ਕੱਟ ਲਓ ਕੱਟ ਚੀਰ ਕੇ ਇਸਨੂੰ ਇੱਕ ਪਾਸੇ ਚੁੱਲ੍ਹੇ 'ਤੇ ਪਾਣੀ ਰਿੱਝਣਾ ਰੱਖ ਦਿਓ ਅੱਧੀ ਪਤੀਲੀ ਅਤੇ ਜਦੋਂ ਇਹ ਉਬਲਣ ਲੱਗ ਜਾਏ ਤਾਂ ਉਸ ਵਿੱਚ ਚੀਰਿਆ ਹੋਇਆ ਸਾਗ ਪਾ ਦਿਓ ਅਤੇ ਉਸ ਤੋਂ ਬਾਅਦ ਇਸ ਨੂੰ ਕਾਫੀ ਟਾਇਮ ਤੱਕ ਪਕਾਈ ਜਾਓ ਅਤੇ ਇੱਕ ਪਾਸੇ ਲਸਣ ਅਤੇ ਅਦਰਕ ਛਿੱਲ ਲਓ ਕੱਟ ਲਓ ਕੱਟ ਕੇ ਅਤੇ ਰੱਖ ਲਓ ਅਤੇ ਇਸਨੂੰ ਸਾਗ ਸਾਗ ਨੂੰ ਰਿੰਨ ਲਓ ਜਦੋਂ ਬਿਲਕੁਲ ਰਿੱਝ ਜਾਊਗਾ ਫਿਰ ਇਸ ਵਿੱਚ ਪਾਣੀ ਦੇਖ ਕੇ ਪਾਣੀ ਪਾਣੀ ਦੇਖ ਕੇ ਇਸ ਵਿੱਚ ਲਸਣ ਅਤੇ ਅਦਰਕ ਪਾ ਦਿਓ ਅਤੇ ਮਿਰਚਾਂ ਪਾ ਦਿਓ ਥੋੜ੍ਹੀ ਦੇਰ ਤੱਕ ਪਕਾਓ ਪਕਾ ਕੇ ਫਿਰ ਇਸ ਵਿੱਚ ਮੱਕੀ ਦਾ ਆਟਾ ਪਾ ਦਿਓ ਅਤੇ ਇਸਨੂੰ ਚੰਗੀ ਤਰ੍ਹਾਂ ਘੋਟ ਲਓ ਬਿਲਕੁਲ ਚੰਗੀ ਤਰ੍ਹਾਂ ਘੋਟ ਲਓ ਅਤੇ ਇੱਕ ਪਾਸੇ ਪਿਆਜ ਅਦਰਕ ਅਤੇ ਲਸਣ ਤੜਕੇ ਲਈ ਕੱਟ ਲਓ ਲਸਣ ਅਤੇ ਪਿਆਜ ਅਦਰਕ ਤੜਕੇ ਵਿੱਚ ਬਿਲਕੁਲ ਪਕਾ ਕੇ ਇਸ ਵਿੱਚ ਸਾਗ ਨੂੰ ਤੜਕਾ ਲਾ ਦਿਓ ਅਤੇ ਅੱਜ ਕੱਲ੍ਹ ਤਾਂ ਸਾਗ ਬਣਾਉਣਾ ਘੋ ਇਲੈਕਟਰ ਇਲੈਕਟ੍ਰੋਨਿਕ ਘੋਟਣੇ ਆਉਣ ਕਰਕੇ ਕਾਫੀ ਆਸਾਨ ਹੋ ਗਿਆ ਹੈ